ਸਾਡੇ ਪੰਜਾਬ ਦੀ ਸੰਸਕ੍ਰਿਤੀ ਬਹੁਤ ਹੀ ਵਧੀਆ ਹੈ ਸਾਡੇ ਪੰਜਾਬ ਵਿੱਚ ਜਾਤ ਪਾਤ ਵਿੱਚ ਕੋਈ ਅੰਤਰ ਨਹੀਂ ਕੀਤਾ ਜਾਂਦਾ ਜਿਵੇਂ ਅਸੀਂ ਇੱਕ ਐਗਜਾਮਪਲ ਲੈ ਲਈਏ ਜਦੋਂ ਅਸੀਂ ਕਿਸੇ ਗੁਰੂ ਘਰ ਦੇ ਵਿੱਚ ਜਾਂਦੇ ਹਾਂ ਤਾਂ ਅਸੀਂ ਇੱਕ ਕਤਾਰ ਦੇ ਵਿੱਚ ਬੈਠ ਕੇ ਇੱਕ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਦੇ ਹਾਂ ਉਸ ਸਮੇਂ ਕਿਸੇ ਨਾਲ ਕੋਈ ਜਾਤ ਪਾਤ ਦਾ ਭੇਵ ਨਹੀਂ ਕੀਤਾ ਜਾਂਦਾ ਜਦੋਂ ਅਸੀਂ ਕਿਤੇ ਸੰਗਤ ਕਿਸੇ ਪਾਠ ਜਾਂ ਕਿਤੇ ਗੁ ਗੁਰੂ ਘਰਾਂ ਦੇ ਵਿੱਚ ਵੀ ਜਾਂਦੇ ਹਾਂ ਉਸ ਸਮੇਂ ਵੀ ਅਸੀਂ ਕਿਸੇ ਨਾਲ ਕੋਈ ਵੀ ਜਾਤ ਪਾਤ ਦਾ ਵਿਤਕਰਾ ਨਹੀਂ ਕਰਦੇ ਅਸੀਂ ਕ ਜਦੋਂ ਕੋਈ ਵੀ ਤਿਉਹਾਰ ਮਨਾਉਂਦੇ ਹਾਂ ਤਾਂ ਅੱਜ ਦਾ ਸਮਾਂ ਇਹ ਕਹਿੰਦਾ ਹੈ ਕਿ ਅਸੀਂ ਹਰ ਤਿਉਹਾਰ ਨੂੰ ਮਨਾ ਲੈਂਦੇ ਹਾਂ ਜਿੱਦਾਂ ਹਿੰਦੂ ਹੈ ਉਹ ਗੁਰਦੁਆਰੇ ਜਾਂਦੇ ਆ ਤੋ ਜੋ ਸਿੱਖ ਹੈ ਉਹ ਮੰਦਿਰਾਂ ਦੇ ਵਿੱਚ ਜਾਂਦੇ ਹੈ ਤੋ ਜੋ ਵੀ ਧਰਮ ਨੇ ਉਹ ਵੀ ਇੱਕ ਤਰ੍ਹਾਂ ਆਪਸ ਦੇ ਵਿੱਚ ਜੁੜਨਾ ਸ਼ੁਰੂ ਹੋ ਗਏ ਨੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਧੰਨਵਾਦ